ਵੈਸੇ ਤਾਂ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਨਿਊਜ਼ ਮੀਡੀਆ ਹੈਗਾ ਵਾ ਉਹ ਸਿਰਫ ਪੇਂਡੂ ਖੇਤਰਾਂ ਦੀਆਂ ਖਬਰਾਂ ਬਾਰੇ ਜ਼ਿਆਦਾ ਦਿਖਾਉਂਦਾ ਹੈ ਕਿਉਂਕਿ ਜਿਹੜੇ ਮੀਡੀਆ ਹੈਗਾ ਵਾ ਉਹਦੇ ਕੋਲ ਹੋਰ ਵੀ ਕਾਫੀ ਸਾਰੀਆਂ ਦੇਸ਼ ਵਿਦੇਸ਼ ਦੁਨੀਆ ਭਰ ਦੀਆਂ ਹੋਰ ਵੀ ਕਾਫੀ ਸਾਰੀਆਂ ਖਬਰਾਂ ਨੇ ਜਿਹੜੀਆਂ ਉਹਨਾਂ ਨੇ ਲੋਕਾਂ ਤੱਕ ਪਹੁੰਚਾਉਣੀਆਂ ਹੁੰਦੀਆਂ ਵਾ ਅਤੇ ਜਿਸ ਤਰ੍ਹਾਂ ਕਿ ਹੁਣ ਦੋ ਹਜ਼ਾਰ ਚੌਵੀ ਦੇ ਇਲੈਕਸ਼ਨ ਆਉਣ ਵਾਲੇ ਆ ਉਹਨਾਂ ਦੀ ਇਲੈਕਸ਼ਨ ਦੀ ਵੀ ਸਾਰੀ ਉਹ ਖਬਰਾਂ ਜਿਹੜੀਆਂ ਲੋਕਾਂ ਨੂੰ ਜਾਗਰੂਕ ਕਰਨਾ ਹੁੰਦਾ ਇਸ ਬਾਰੇ ਕਿ ਵੋਟ ਪਾਉ ਅਤੇ ਕੋਈ ਮੈਨੂੰ ਨਹੀਂ ਲੱਗਦਾ ਕਿ ਕੋਈ ਅਜਿਹਾ ਮੁੱਦਾ ਵਾ ਜਿਨ੍ਹਾਂ ਬਾਰੇ ਅਸੀਂ ਮੀਡੀਏ ਵੱਲੋਂ ਨਹੀਂ ਜਾਣ ਸਕਦੇ ਕਿਉਂਕਿ ਅੱਜ ਕੱਲ੍ਹ ਜਿਹੜਾ ਟੈਕਨੋਲਜੀ ਦਾ ਜ਼ਮਾਨਾ ਹੈਗਾ ਵਾ ਅਤੇ ਮੀਡੀਏ ਕੋਲ ਗੱਲ ਬਾਅਦ ਵਿੱਚ ਪਹੁੰਚਦੀ ਹੈ ਅਤੇ ਆਮ ਜਿਹੜੀ ਪਬਲਿਕ ਹੁੰਦੀ ਹੈ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦੀ ਹੈ ਅਤੇ ਉਹਨਾਂ ਨੂੰ ਇਸ ਤਰ੍ਹਾਂ ਪਤਾ ਲੱਗਦੀ ਹੈ ਕਿ ਫੋਨਾਂ ਦੇ ਦੁਆਰਾ ਯੂਟੀਊਬ ਫੇਸਬੁੱਕ 'ਤੇ ਦੁਆਰਾ ਉਹਨਾਂ ਨੂੰ ਟੀ ਵੀ ਦੇ ਨਾਲੋਂ ਜਾਂ ਖਬਰਾਂ ਦੇ ਨਾਲੋਂ ਪਹਿਲਾਂ ਹੀ ਫੋਨਾਂ 'ਤੇ ਖਬਰਾਂ ਪਤਾ ਲੱਗ ਜਾਂਦੀਆਂ ਹਨ ਅਤੇ ਜਿਹੜਾ ਮੀਡੀਆ ਵੀ ਆ ਲੋਕਾਂ ਤੋਂ ਹੀ ਜ਼ਿਆਦਾ ਖਬਰਾਂ ਇਕੱਤ੍ਰਿਤ ਕਰਦਾ ਹੈਗਾ ਲੋਕਾਂ ਨੂੰ ਦਿਖਾਉਣ ਵਾਸਤੇ